ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਮੁੱਖ ਜਿਹੜਾ ਕਿੱਤਾ ਆ ਖੇਤੀਬਾੜੀ ਆ ਲੋਕ ਜਿਹੜੇ ਗ੍ਰਾਮੀਣ ਲੋਕ ਨੇ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਖੇਤੀਬਾੜੀ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਇਹਦੇ ਵਿੱਚ ਲੋਕ ਫਸਲਾਂ ਜਿਵੇਂ ਖੇਤੀਬਾੜੀ ਦੇ ਵਿੱਚ ਫਸਲਾਂ ਉਗਾਉਂਦੇ ਨੇ ਜਿਵੇਂ ਕਣਕ ਹੋ ਗਈ ਝੋਨਾ ਹੋ ਗਿਆ ਮੱਕੀ ਹੋ ਗਈ ਇਹਨਾਂ ਫਸਲਾਂ ਨੂੰ ਉਗਾ ਕੇ ਉਹ ਆਪਣਾ ਜਿਹੜਾ ਆ ਗੁਜ਼ਾਰਾ ਕਰਦੇ ਨੇ ਅਤੇ ਅਗਰ ਆਪਾਂ ਪਸ਼ੂ ਪਾਲਣ ਦੀ ਗੱਲ ਕਰੀਏ ਤਾਂ ਇਹ ਪਸ਼ੂ ਪਾਲਣ ਵੀ ਜਿਹੜੇ ਗ੍ਰਾਮੀਣ ਲੋਕ ਨੇ ਜਾਂ ਸ਼ਹਿਰਾਂ ਦੇ ਲੋਕ ਨੇ ਉਹ ਦੁੱਧ ਵੇਚਣਾ ਦਹੀਂ ਵੇਚਣਾ ਇਸ ਚੀਜ਼ ਨੂੰ ਵੀ ਐਜ਼ ਆ ਪ੍ਰੋਫੈਸ਼ਨ ਅਪਣਾ ਰਹੇ ਨੇ ਅਤੇ ਇਹਦੇ ਵਿੱਚ ਵੀ ਜਿਵੇਂ ਡਾਇਰੀ ਫਾਰਮ ਖੋਲ੍ਹ ਖੋਲ੍ਹ ਰੱਖੇ ਨੇ ਕਈ ਲੋਕਾਂ ਨੇ ਕਈ ਲੋਕ ਮੁਰਗੀ ਪਾਲਣ ਕਰਦੇ ਨੇ ਕਈ ਲੋਕ ਜਿਹੜਾ ਮੱਛੀ ਫਾਰਮ ਚਲਾਉਂਦੇ ਨੇ ਜਿਹਦੇ ਨਾਲ ਉਹਨਾਂ ਦੀ ਆਮਦਨੀ ਹੁੰਦੀ ਆ